ਛੋਟੇ ਹੁੰਦੇ ਮੈਂ ਸ਼ੇਖ ਚਿੱਲੀ ਦੀ ਇੱਕ ਬੁੱਕ ਪੜ੍ਹੀ ਸੀ ਸ਼ੇਖ ਚਿੱਲੀ ਦੀ ਬੁੱਕ ਲਿਖੀ ਹੋਈ ਹੈ ਉਹਦੇ ਵਿੱਚ ਸ਼ੇਖ ਚਿਲੀ ਦੀ ਘਟਨਾ ਸੀਗੀ ਕਿ ਉਹ ਕੀ ਹੈ ਕੋਈ ਕੰਮ ਕਾਰ ਨਹੀਂ ਕਰਦਾ ਸੀਗਾ ਬਸ ਵਿਹਲਾ ਹੀ ਬੈਠਾ ਰਹਿੰਦਾ ਸੀਗਾ ਅਤੇ ਛੋਟੇ ਛੋਟੇ ਸੀਗੇ ਅਸੀਂ ਅਸੀਂ ਵੀ ਮਤਲਬ ਪੜ੍ਹ ਕੇ ਬਹੁਤ ਸਾਨੂੰ ਹਾਸਾ ਆਇਆ ਕਿ ਉਹਨੂੰ ਨਾ ਮਤਲਬ ਕਿਸੇ ਨੇ ਪੈਸੇ ਦਿੱਤੇ ਉਸ ਨੇ ਸੋਚਿਆ ਕਿ ਚਲੋ ਠੀਕ ਹੈ ਮੈਂ ਆਂਡੇ ਲੈ ਲਵਾਂਗਾ ਅੰਡੇ ਖਰੀਦ ਲਏ ਉਸਨੇ ਫਿਰ ਸੁੱਤੇ ਸੁੱਤੇ ਨੇ ਈ ਔਰ ਆਂਡੇ ਖਰੀਦਲੇ ਫਿਰ ਉਹਦਾ ਵਿਆਹ ਹੋ ਗਿਆ ਫਿਰ ਉਹਦੇ ਬੱਚਿਆਂ ਨੂੰ ਤੰਗ ਕਰਨਾ ਸ਼ੁਰੂ ਕਰਤਾ ਫਿਰ ਉਹਨੇ ਆਪਣੇ ਬੱਚਿਆਂ ਨੂੰ ਠੁੱਡ ਮਾਰਿਆ ਅਤੇ ਜਦੋਂ ਠੁੱਡ ਮਾਰਿਆ ਅਤੇ ਉਹਦੇ ਆਂਡੇ ਥੱਲੇ ਡਿੱਗ ਗੇ ਅਤੇ ਉਹ ਬੋਲਿਆ ਹੱਟ ਭਲੂਆ ਉੱਠ ਕੇ ਮਤਲਬ ਉਹ ਜਾਗ ਗਿਆ ਅਤੇ ਉਹ ਤੋਂ ਫਿਰ ਸਾਨੂੰ ਇਨਾ ਹਾਸਾ ਆਇਆ ਕਿ ਦੇਖੋ ਸੱਤਾ ਸੁੱਤਾ ਹੀ ਆਪਣੇ ਖਿਆਲੀ ਪਲਾਓ ਬਣਾ ਕੇ ਰਾਜਾ ਬਣ ਗਿਆ ਸੀਗਾ ਇੱਕ ਮਿੰਟ 'ਚ ਇਹ ਕੰਗਾਲ ਹੋ ਗਿਆ ਇੱਕ ਮਿੰਟ 'ਚ ਇਹ ਰਾਜਾ ਬਣ ਗਿਆ ਅਤੇ ਉਥੋਂ ਸਾਨੂੰ ਬਹੁਤ ਹਾਸਾ ਆਇਆ ਕਿ ਦੇਖੋ ਆਪਣੇ ਆਂਡੇ ਵੀ ਨੇ ਗਿਰਾ ਲਏ ਆਪਣੇ ਬਾਅਦ 'ਚ ਬੜਾ ਰੋਇਆ ਅਤੇ ਬਾਅਦ ਵਿੱਚ ਬੜਾ ਹੱਸਿਆ ਕਿ ਇਹ ਕਹਿੰਦਾ ਇਹ ਤਾਂ ਬਸ ਇੱਕ ਮੇਰਾ ਸੁਪਨਾ ਹੀ ਸੀਗਾ ਅਤੇ ਉਹ ਕਹਾਣੀ ਪੜ੍ਹ ਕੇ ਸਾਨੂੰ ਬਹੁਤ ਹੀ ਹਾਸਾ ਆਇਆ ਸਾਰੇ ਕਲਾਸ ਨੂੰ ਸਾਨੂੰ ਹੁਣ ਤਿੱਕਰ ਉਹ ਕਹਾਣੀ ਮੈਨੂੰ ਯਾਦ ਹੈ